ਹਾਂ ਹੈਲੋ ਪ੍ਰਭ ਕਿਵੇਂ ਹੈ ਹੋਰ ਵਧੀਆ ਕਿਵੇਂ ਅੱਜ ਕਿਵੇਂ ਯਾਦ ਕੀਤਾ ਹਾਂ ਅੱਛਾ ਤੂੰ ਅੱਛਾ ਜਿਹੜੀ ਮੈਂ ਤੈਨੂੰ ਕਿਹਾ ਸੀ

ਹੂੰ ਬੋਲੋ ਹਾਂ ਹੂੰ ਹਾਂ

ਹਾਂ ਨਹੀਂ ਇਹ ਚੀਜ਼ ਤਾਂ ਹੈਗੀ ਆ ਜਿਵੇਂ ਹੁਣ ਪਹਿਲਾਂ ਮੈਂ ਵੀ ਕਦੇ ਸਾਇਕੋਲੋਜੀ ਪੜ੍ਹੀ ਨਹੀਂ ਪਰ ਮੈਂ ਵੀ ਸਾਇਕੋਲੋਜੀ ਇਸ ਬਾਰ ਫਸਟ ਟਾਈਮ ਪੜ੍ਹ ਰਹੀ ਹਾਂ ਪਰ ਮੈਨੂੰ ਪੜ੍ਹ ਕੇ ਬੜਾ ਵਧੀਆ ਲੱਗ ਰਿਹਾ ਕਿਉਂਕਿ ਇਹਦੇ ਨਾਲ ਕੀ ਹੈ ਜਿਵੇਂ ਹੁਣ ਆਪਾਂ ਵੀ ਆਪਾਂ ਵੀ ਕੀ ਕਹਿੰਦੇ ਹੁੰਦੇ ਪਹਿਲਾਂ ਗੁਜ਼ਰਿਆ ਵੀ ਆਪਣੀ ਵੀ ਟੀਨਏਜ ਸੀਗੀ ਠੀਕ ਆ ਵੀ ਹੁਣ ਆਪਾਂ ਉਦੋਂ ਇਹੋ ਜਿਹਾ ਰਿਐਕਸ਼ਨ ਕਾਹਤੋਂ ਕਰਦੇ ਸੀ ਤਾਂ ਹੁਣ ਪਤਾ ਲੱਗਦਾ ਬਾਕੀ ਇਸ ਦੇ ਨਾਲ ਜਿਵੇਂ ਹੁਣ ਆਪਣੀ ਵੀ ਛੋਟੇ ਭੈਣ ਭਰਾ ਹੈਗੇ ਆ ਜਾਂ ਫਿਰ ਆਪਣੇ ਵੀ ਆਂਢ ਗੁਆਂਢ ਵਿੱਚ ਬੱਚੇ ਆ ਉਹਨਾਂ ਦੀ ਸਾਇਕੋਲੋਜੀ ਦਾ ਪਤਾ ਲੱਗਦਾ ਉਹਨਾਂ ਨੂੰ ਗਾਈਡੈਂਸ ਆਪਾਂ ਦੇ ਸਕਦੇ ਹਾਂ ਵੀ ਹਾਂ ਵੀ ਚਲੋ ਉਹਨਾਂ ਦੇ ਮਾਂ ਪਿਓ ਨੂੰ ਆਪਾਂ ਗਾਈਡੈਂਸ ਦੇ ਸਕਦੇ ਹਾਂ ਜਾਂ ਫਿਰ ਜਿਵੇਂ ਹੁਣ ਆਪਾਂ ਨੂੰ ਵੀ ਕੋਈ ਨਵਾਂ ਆਪਾਂ ਨੂੰ ਬੰਦਾ ਮਿਲਦਾ ਹੈ ਨਾ ਫਿਰ ਆਪਾਂ ਉਹਨਾਂ ਨਾਲ ਵੀ ਉਹਨਾਂ ਦੀ ਸਾਈਡ ਤੋਂ ਵੀ ਆਪਾਂ ਥੋੜ੍ਹੀ ਬਹੁਤ ਪੜ੍ਹ ਸਕਦੇ ਹਾਂ ਇੰਟਰਸਟਿੰਗ ਸਬਜੈਕਟ ਹੈ ਮੈਨੂੰ ਬਹੁਤ ਵਧੀਆ ਲੱਗਿਆ ਪੜ੍ਹਕੇ ਪਹਿਲੀ ਵਾਰ ਬਾਕੀ ਇਸਦੇ ਨਾਲ ਜਿਵੇਂ ਹੁਣ ਆਪਾਂ ਨੂੰ ਵੀ ਅਕਸਰ ਅੱਗੇ ਜਾ ਕੇ ਹੈ ਨਾ ਵਿਚਾਰ ਡਿਵਲਪਮੈਂਟ ਦਾ ਆਪਾਂ ਨੂੰ ਹੁਣੇ ਪਤਾ ਲੱਗ ਜਾਂਦਾ ਅੱਗੇ ਜਾ ਕੇ ਆਪਣੇ ਲਈ ਵੀ ਇਹ ਚੰਗਾ ਹੋਊਗਾ ਕਿਉਂਕਿ ਆਪਾਂ ਫਿਰ ਅੱਗੇ ਜਾ ਕੇ ਆਪਾਂ ਵੀ ਫੈਮਲੀ ਮੈਨ ਬਣਨਾ ਫੈਮਲੀ ਵੂਮੈਨ ਮਨ ਬਣਨਾ ਹੈ ਨਾ ਤਾਂ ਫਿਰ ਆਪਾਂ ਵੀ ਸਰ ਸਹੀ ਗੱਲ ਆ ਬਹੁਤ ਵਧੀਆ ਲੱਗਿਆ ਸਗੋਂ ਇਸ ਵਾਰ ਸਾਇਕੋਲੋਜੀ ਪੜ੍ਹ ਕੇ ਹੁਣ ਸਗੋਂ ਮੇਰਾ ਹੋਰ ਵੀ ਇੰਟਰਸਟ ਜਾਗ ਰਿਹਾ ਮੈਂ ਵੀ ਸੋਚਿਆ ਸੀ ਵੀ ਚਲੋ ਲਾਈਬ੍ਰੇਰੀ ਵਿੱਚ ਜਾ ਕੇ ਹੋਰ ਬੁੱਕਸ ਵੇਖੂੰਗੀ ਅਤੇ ਜਿਹੜੀਆਂ ਮੈਨੂੰ ਮਤਲਬ ਕਿ ਵਧੀਆ ਲੱਗੇ ਸਾਈਕੋਲੋਜੀ ਦੇ ਵੀ ਹੋਰ ਵੀ ਪੜੂੰਗੀ ਹੂੰ ਹੂੰ

ਹੂੰ

ਨਹੀਂ ਨਹੀਂ ਇਹ ਬਹੁਤ ਵਧੀਆ ਨਾਲੇ ਬੁੱਕ ਵੀ ਆਪਾਂ ਨੂੰ ਬਹੁਤ ਵਧੀਆ ਪ੍ਰੋਵਾਈਡ ਮਤਲਬ ਕਿ ਓਥਰ ਬੁਹਤ ਵਧੀਆ ਜਿਹਨਾਂ ਦੀ ਆਪਾਂ ਨੂੰ ਬੁੱਕ ਸਰ ਨੇ ਕਹੀ ਸੀਗੀ ਉਸਦੇ ਨਾਲ ਨਾਲ ਹੋਰ ਵੀ ਓਥਰਸ ਦੀ ਸਰ ਤੋਂ ਆਪਾਂ ਰੈਕਮਡੇਸ਼ਨ ਲੈ ਕੇ ਉਹਦੀ ਉਹ ਸਾਈਕੋਲੋਜੀ ਦੀਆਂ ਬੁੱਕਸ ਪੜ੍ਹ ਸਕਦੇ ਹੈ ਨਾ ਤਾਂ ਕਰਕੇ ਵੀ ਇਹਦੇ ਨਾਲ ਚੱਲ ਆਪਣੀ ਨੌਲੇਜ ਹੋਰ ਗੇਨ ਹੋ ਗਿਆ ਇਸਦੇ ਨਾਲ ਆਪਾਂ ਨੂੰ ਆਪਣੇ ਜਿਹੜਾ ਹੈਲਪ ਹੈ ਸਬਜੈਕਟ ਵਿੱਚ ਵੀ ਆਪਾਂ ਨੂੰ ਹੈਲਪ ਮਿਲੂਗੀ ਹੋਰ ਚਲੋ ਵਧੀਆ ਗੱਲ ਹੈ ਵੀ ਆਪਾਂ ਨੂੰ ਚਲੋ ਬੁੱਕਸ ਨਾਲ ਤਾਂ ਪਿਆਰ ਆਪਾਂ ਨੂੰ ਪਹਿਲਾਂ ਤੋਂ ਹੀ ਸੀ ਪਰ ਹੁਣ ਆਪਾਂ ਨੂੰ ਇੱਕ ਨਵਾਂ ਸਬਜੈਕਟ ਮਿਲ ਗਿਆ ਜਿਹਦੇ ਨਾਲ ਜਿਹਦੇ ਵਿੱਚ ਆਪਣਾ ਇੰਟਰਸਟ ਜਾਗਿਆ

ਹੂੰ

ਹਾਂ ਮੈਨੂੰ ਵੀ ਬਹੁਤ ਵਧੀਆ ਲੱਗਿਆ ਆਪਣਾ ਵਿਊ ਸ਼ੇਅਰ ਕਰਕੇ ਥੈਂਕ ਯੂ